ਖਾਣ ਲਈ ਮੇਰੀ ਮਨਪਸੰਦ ਭੋਜਨ ਖੀਰ ਕੜਾਹ ਹੈ ਖੀਰ ਵਿੱਚ ਬਹੁਤ ਪੋਸ਼ਟਿਕ ਤੱਤ ਹੁੰਦੇ ਹਨ ਖੀਰ ਦੁੱਧ ਅਤੇ ਚੌਲ਼ਾਂ ਦੇ ਸੁਮੇਲ ਨਾਲ ਬਣਦੀ ਹੈ ਇਹ ਇਹਦੇ ਵਿੱਚ ਸਵਾਦ ਅਨੁਸਾਰ ਮਿੱਠਾ ਪਾਇਆ ਜਾਂਦਾ ਹੈ ਅਤੇ ਕਾਜੂ ਬਦਾਮ ਅਤੇ ਦਾਖਾਂ ਵੀ ਪਾਈਆਂ ਜਾਂਦੀਆਂ ਹਨ ਕੜਾਹ ਸੂਜੀ ਜਾਂ ਆਟੇ ਦਾ ਬਣਾਇਆ ਜਾਂਦਾ ਹੈ ਉਹਦੇ ਵਿੱਚ ਵੀ ਦਾਖਾਂ ਅਤੇ ਕਾਜੂ ਅਪ ਪਾ ਸਕਦੇ ਹਾਂ